ਉਨੱਤੀ ਬਾਰਾਂ ਉੱਨੀ ਛਿਆਸੀ ਤੇਈ ਸਤੰਬਰ ਵੀਹ ਬਾਰਾਂ ਪੰਦਰਾਂ ਜਨਵਰੀ ਵੀਹ ਪੰਦਰਾਂ ਛੇ ਮਾਰਚ ਵੀਹ ਵੀਹ ਅਠਾਰਾਂ ਅਕਤੂਬਰ ਵੀਹ ਬਾਈ